ਭਾਰਤ ਵਿੱਚ ਨੌਕਰੀ ਬਾਜ਼ਾਰ ਕਾਫੀ ਬਦਲ ਗਿਆ ਹੈ ਇਹ ਪੁਰਾਣੇ ਰਿਵਾਇਤੀ ਢੰਗਾਂ ਨੂੰ ਛੱਡ ਕੇ ਨਵੇਂ ਤਕਨੀਕੀ ਢੰਗਾਂ ਵੱਲ ਅੱਗੇ ਅਗਰਸਰ ਵੱਧ ਰਿਹਾ ਅਤੇ ਜਿਸ ਨਾਲ ਕਾਫੀ ਲੋਕ ਨਵੀਂ ਤਕਨੀਕੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਲੋਕਾਂ ਵਿੱਚ ਆਪਸੀ ਮੁਕਾਬਲਾ ਕਾਫੀ ਵੱਧ ਗਿਆ ਹੈ ਕਿਉਂਕਿ ਇਹ ਭਾਰਤ ਦੀ ਜਨਸੰਖਿਆ ਕਾਫੀ ਜ਼ਿਆਦਾ ਹੋਣ ਕਰਕੇ ਕਾਫੀ ਲੋਕ ਇੱਕੋ ਚੀਜ਼ ਨੂੰ ਸ ਸਿੱਖਿਆ ਪ੍ਰਾਪਤ ਕਰਕੇ ਉਸੀ ਚੀਜ਼ ਵੱਲ ਅੱਗੇ ਵੱਧ ਰਹੇ ਹਨ ਅਤੇ ਅ ਨੌਕਰੀਆਂ ਇਸ ਕਾਰਨ ਘੱਟ ਗਈਆਂ ਹਨ ਅਤੇ ਆਪਾਂ ਮੈਂ ਵੀ ਇਸੀ ਫੀਲਡ ਵਿੱਚ ਕੰਮ ਕਰ ਰਿਹਾ ਮੈਂ ਵੈਬ ਡਿਜਾਇਨਿੰਗ ਦਾ ਕੰਮ ਕਰਦਾ ਹਾਂ ਜਿਸ ਨਾਲ ਮੈਂ ਵੈਬਸਾਈਟਸ ਵਗੈਰਾ ਬਣਾਉਨਾ ਅਤੇ ਮੈਂ ਆਪ ਦੇਖਦਾ ਹਾਂ ਕਿ ਮੇਰੀ ਫੀਲਡ ਵਿੱਚ ਨੌਕਰੀਆਂ ਵਾ ਕਿੰਨੀਆਂ ਘੱਟ ਗਈਆਂ ਹਨ ਕਿਉਂਕਿ ਕਾਫੀ ਲੋਕ ਇਹੀ ਚੀਜ਼ ਸਿੱਖਿਆ ਪ੍ਰਾਪਤ ਕਰ ਰਹੇ ਹਨ ਕਿਉਂਕਿ ਅੱਜ ਦੇ ਜਮਾਨੇ ਵਿੱਚ ਤਕਨੀਕੀ ਸਿੱਖਿਆ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਆਮ ਤੌਰ 'ਤੇ ਇਹ ਸਿੱਖਿਆ ਕਿਸੀ ਵੀ ਰਿਸੋਰਸ ਰਾਹੀਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਤਾਂ ਇਸੀ ਅੱਜ ਦਾ ਜ਼ਮਾਨਾ ਡਿਜੀਟਲ ਜ਼ਮਾਨਾ ਹੈ ਜਿਸ ਕਰਕੇ ਲੋਕ ਜ਼ਿਆਦਾਤਰ ਇਹ ਡਿਜੀਟਲ ਚੀਜ਼ਾਂ ਤਕਨੀਕੀ ਸਿੱਖਿਆ ਵਗੈਰਾ ਪ੍ਰਾਪਤ ਕਰ ਰਹੇ ਹਨ ਅਤੇ ਇਹ ਤਕਨੀਕੀ ਸਿੱਖਿਆ ਨਾਲ ਆਪਾਂ ਆਉਣ ਵਾਲੀ ਪੀੜ੍ਹੀ ਦਾ ਆਪਾਂ ਕਾਫੀ ਧਿਆਨ ਰੱਖ ਸਕਦੇ ਹਾਂ ਏ ਆਈ ਜਿਵੇਂ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਵਗੈਰਾ ਆ ਗਈ ਹੈ ਅਤੇ ਇਹਦੇ ਨਾਲ ਸਾਡਾ ਕੰਮ ਬਹੁਤ ਆਸਾਨ ਹੋ ਗਿਆ ਲੇਕਿਨ ਉਸੀ ਤਰੀਕੇ ਨਾਲ ਸਾਡੇ ਕੰਮ ਸਾਡਾ ਕੰਮ ਖ਼ਤਰੇ ਵਿੱਚ ਵੀ ਹੈ ਕਿਉਂਕਿ ਏ ਆਈ ਆਪਾਂ ਦੇਖ ਰਹੇ ਹਾਂ ਕਿ ਇਹ ਕਿੰਨਾ ਖ਼ਤਰਨਾਕ ਹੋ ਸਕਦਾ ਹੈ ਇਹ ਸਾਡਾ ਕੰਮ ਸਾਡੇ ਤੋਂ ਛਿਨ ਵੀ ਸਕਦਾ ਇਸ ਕਰਕੇ ਭਾਰਤ ਵਿੱਚ ਨੌਕਰੀਆਂ ਦਾ ਬਾਜ਼ਾਰ ਕਾਫੀ ਬਦਲ ਰਿਹਾ